ਮੇਰਾ ਨਾਮ ਨੰਦਨੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਗਿੱਦੜਵਾਹਾ ਦੀ ਰਹਿਣ ਵਾਲੀ ਹਾਂ ਸਮਾਜ ਵਿੱਚ ਡਾਂਸਰਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਮਾਜ ਵਿੱਚ ਡਾਂਸ ਦਾ ਕੋਈ ਚੰਗਾ ਅਹੁਦਾ ਨਹੀਂ ਸਮਝਿਆ ਜਾਂਦਾ ਇਸ ਤਰ੍ਹਾਂ ਮੈਂ ਵੀ ਇੱਕ ਡਾਂਸਰ ਦੀ ਸੰਘਰਸ਼ ਦੀ ਕਹਾਣੀ ਤੋਂ ਜਾਣੂ ਹਾਂ ਕਿਉਂਕਿ ਮੈਂ ਉਸਨੂੰ ਅੱਖਾਂ ਸਾਹਮਣੇ ਵੇਖਿਆ ਹੋਇਆ ਹੈ ਇਸ ਤਰ੍ਹਾਂ ਕਰਦੇ ਹੋਏ ਉਸ ਦਾ ਘਰ ਪਿੰਡ ਵਿੱਚ ਹੈ ਜ ਉਸਦਾ ਨਾਮ ਖੁਸ਼ੀ ਹੈ ਉਸਦੇ ਘਰ ਵਾਲੇ ਡਾਂਸ ਲਈ ਕੋਈ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸੀ ਜਦੋਂ ਉਸਨੇ ਕਾਲਜ ਵਿੱਚੋਂ ਫਸਟ ਪ੍ਰਾਈਜ਼ ਡਾਂਸ 'ਚੋਂ ਜਿੱਤਿਆ ਫਿਰ ਦੂਸਰਾ ਪ੍ਰਾਈਜ਼ ਜਿੱਤਿਆ ਇੰਟਰ ਯੂਨੀਵਰਸਿਟੀ ਜਿੱਤੀ ਇਸ ਤਰ੍ਹਾਂ ਉਸਨੇ ਤਿੰਨ ਸਾਲ ਕਾਲਜ ਤੋਂ ਬਾਅਦ ਆਪਣਾ ਡਾਂਸ ਅਕੈਡਮੀ ਖੋਲ੍ਹ ਕੇ ਬਹੁਤ ਤਰ੍ਹਾਂ ਦੇ ਬੱਚਿਆਂ ਨੂੰ ਸਟੈਂਡ ਕਰਕੇ ਡਾਂਸ ਵਿੱਚ ਡਾਂਸ ਸਿਖਾ ਕੇ ਕਈ ਤਰ੍ਹਾਂ ਦੇ ਬੱਚਿਆਂ ਨੂੰ ਇੰਡੀਆ ਟੀ ਵੀ ਜਿਹੜਾ ਕਿ ਫ ਬਹੁਤ ਜ਼ਿਆਦਾ ਫੇਮਸ ਹੈ ਭਾਰਤ ਵਿੱਚ ਅਤੇ ਉਸ ਉਹਨਾਂ ਬੱਚਿਆਂ ਨੂੰ ਟ੍ਰੇਨਡ ਕਰਕੇ ਬਾਹਰ ਭੇਜੇ ਡਾਂਸ ਕਰਵਾਇਆ ਇਸ ਤਰ੍ਹਾਂ ਉਸਨੂੰ ਆਮਦਨ ਵੀ ਪ੍ਰਾਪਤ ਹੋਈ ਅਤੇ ਇੱਕ ਨਾਮ ਵੀ ਪ੍ਰਾਪਤ ਹੋਇਆ ਉਸਦੇ ਘਰ ਦੇ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਉਹਦੇ ਉਹਨਾਂ ਦੀ ਬੇਟੀ ਡਾਂਸਰ ਬਣੇ ਡਾਂਸ ਅਕੈਡਮੀ ਖੋਲ੍ਹੇ ਪਰ ਉਸਨੇ ਕਰ ਦਿਖਾਇਆ ਇੱਕ ਅਡਾਂਸ ਅਕੈਡਮੀ ਖੋਲ੍ਹ ਕੇ ਅਤੇ ਬੱਚਿਆਂ ਨੂੰ ਟ੍ਰੇਨਡ ਕੀਤਾ ਅਤੇ ਬਾਹਰ ਭੇਜੇ ਇਸ ਤਰ੍ਹਾਂ ਉਸਦਾ ਬਹੁਤ ਵੱਡਾ ਨਾਮ ਹੋਇਆ ਇੰਡੀਆ ਟੀ ਵੀ ਦੇ ਵਿੱਚ ਜਦੋਂ ਉਸਨੇ ਆਪਣੇ ਟ੍ਰੇਂਡ ਕੀਤੇ ਹੋਏ ਬੱਚੇ ਭੇਜੇ ਤਾਂ ਉਹ ਬੱਚਿਆਂ ਦੀ ਸੈਕਿੰਡ ਪੁਜੀਸ਼ਨ ਆਈ ਹੈ ਇੰਡੀਆ ਟੀ ਵੀ ਦੇ ਵਿੱਚ ਅਤੇ ਅੱਗੇ ਉਹ ਅਦਰ ਕੰਟਰੀਜ਼ ਦੇ ਵਿੱਚ ਵੀ ਜਾਣਗੇ ਅਤੇ ਦੂਸਰਾ ਯੂਟੀਊਬ ਚੈਨਲ ਵੀ ਅੱਜ ਕੱਲ੍ਹ ਬਹੁਤ ਫੇਮਸ ਹੈ ਜਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਡਾਂਸਰਸ ਅੱਜ ਕੱਲ੍ਹ ਯੂਟਿਊਬ 'ਤੇ ਚੈਨਲ ਬਣਾ ਕੇ ਆਪਣਾ ਕਿਰਦਾਰ ਦਿਖਾ ਰਹੇ ਹਨ ਬੱਚਿਆਂ ਨੂੰ ਡਾਂਸ ਸਿਖਾ ਰਹੇ ਹਨ ਅਤੇ ਬੱਚੇ ਡਾਂਸ ਸਿੱਖ ਵੀ ਰਹੇ ਹਨ ਇਸ ਨਾਲ ਕੀ ਹੁੰਦਾ ਹੈ ਨਾ ਤਾਂ ਉਹ ਬਾਹਰ ਜਾਂਦੇ ਹਨ ਡਾਂਸ ਸਿਖਾਉਣ ਵਿੱਚ ਕਰਨ ਡਾਂਸ ਸਿਖਾਉਣ ਲਈ ਬਾ ਅੰਦਰ ਹੀ ਅੰਦਰ ਆਪ ਆਪਣਾ ਕੀਤਾ ਕਰਕੇ ਪੈਸੇ ਕਮਾ ਰਹੇ ਹਨ ਹੁਨਰ ਦਿਖਾ ਰਹੇ ਹਨ ਧੰਨਵਾਦ